ਜੇ ਭਾਰਤ ਦੇ ਵਾਤਾਵਰਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਾਤਾਵਰਨ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਹੀ ਜ਼ਿਆਦਾ ਹੀ ਬਦਲਾਵ ਆਇਆ ਜੇ ਗਰਮੀ ਹੁੰਦੀ ਆ ਤਾਂ ਅੱਤ ਦੀ ਹੁੰਦੀ ਆ ਜੇ ਸਰਦੀ ਹੁੰਦੀ ਤਾਂ ਉਹ ਵੀ ਅੱਤ ਦੀ ਹੁੰਦੀ ਆ ਅਤੇ ਮੀਂਹ ਦੀ ਤਾਂ ਗੱਲ ਹੀ ਨਾ ਕਰੋ ਇੰਨਾ ਮੀਂਹ ਕਦੀ ਕਦੀ ਤਾਂ ਗੜੇ ਵੀ ਪੈ ਹੀ ਜਾਂਦੇ ਆ ਫਿਰ ਸੋਚਣ ਵਾਲੀ ਗੱਲ ਇਹ ਹੈ ਕਿ ਆਪਣੇ ਵਾਤਾਵਰਨ 'ਚ ਇੰਨੇ ਬਦਲਾਵ ਆ ਹੀ ਕਿਉਂ ਰਹੇ ਨੇ ਕੀ ਰੀਜ਼ਨ ਹੋ ਸਕਦਾ ਆ ਗਲੋਬਲ ਵਾਰਮਿੰਗ ਅਫ ਕੋਰਸ ਗਲੋਬਲ ਵਾਰਮਿੰਗ ਕਰਕੇ ਹੋ ਰਿਹਾ ਵਾ ਜਿੱਦਾਂ ਵੀ ਗਲੋਬਲ ਵਾਰਮਿੰਗ ਦੇ ਕਰਕੇ ਹੀ ਸਾਰਾ ਕੁਛ ਓਜ਼ਨ ਦੀ ਲੇਅਰ ਜਿਹੜੀ ਉਹ ਡਿਪਲੀਟ ਹੋ ਰਹੀ ਆ ਜਾਂ ਜਿੱਦਾਂ ਵੀ ਆ ਜੇ ਵਹੀਕਲ ਦੇ ਵਿੱਚੋਂ ਧੂੰਏਂ ਇੰਨੇ ਨਿਕਲਦੇ ਪਏ ਨੇ ਜੇ ਕਿਸੇ ਨੇ ਇੱਥੇ ਛੋ ਆਪਣੇ ਘਰ ਦੀ ਲਾਗੇ ਵਾਲੀ ਦੁਕਾਨ 'ਤੇ ਵੀ ਜਾਣਾ ਤਾਂ ਵੀ ਲੋਕ ਕਈ ਕਾਰ 'ਤੇ ਜਾਂਦੇ ਆ ਜਿਹਦੇ ਕਰਕੇ ਪੋਲਿਊਸ਼ਨ ਕਿੰਨਾ ਹੁੰਦਾ ਵਾ ਵਹੀਕਲ 'ਚੋਂ ਜਿਹੜੇ ਨਿਕਲਦੇ ਆ ਧੂੰਏਂ ਫਿਰ ਫੈਕਟਰੀਆਂ ਦੇ ਧੂੰਏਂ ਇੰ ਇਹਦੇ ਕਰਕੇ ਸਾਰਾ ਵਾਤਾਵਰਨ ਵਿੱਚ ਚੇਂਜਿਜ ਆ ਰਹੇ ਨੇ ਪੇੜ ਕੱਟੀ ਜਾਂਦੇ ਆ ਆਕਸੀਜਨ ਦਾ ਫਿਰ ਆਕਸੀਜਨ ਦੀ ਵੀ ਕਮੀ ਆਏਗੀ ਕਦ ਕਦੀ ਨਾ ਕਦੀ ਜਾ ਕੇ ਪੇੜ ਕੱਟ ਰਹੇ ਨੇ ਫੈਕਟਰੀਆਂ ਬਣ ਰਹੀਆਂ ਵਾ ਘਰ ਬਣੀ ਜਾਂਦੇ ਆ ਪੇੜ ਤਾਂ ਹੈ ਹੀ ਨਹੀਂ ਕਿਤੇ ਵੀ ਹਵਾ ਵੀ ਨਹੀਂ ਸਾਫ ਰਹੀ ਇਸ ਕਰਕੇ ਸਰਦੀ ਗਰਮੀ ਠੰਡ ਹਰ ਮੌਸਮ ਵਿੱਚ ਇੰਨੇ ਚੇਂਜਿਜ ਹੋਏ ਆ ਕਿ ਦੱਸ ਹੀ ਨਹੀਂ ਸਕਦੇ ਠੰਡ ਅੰਤਾਂ ਦੀ ਹੁੰਦੀ ਆ ਬਰਦਾਸ਼ਤ ਤੋਂ ਬਾਹਰ ਹੁੰਦੀ ਆ ਗਰਮੀ ਐਨੀ ਜ਼ਿਆਦਾ ਬੰਦੇ ਦਾ ਘਰੋਂ ਨਿਕਲਣ ਦਾ ਹੀ ਨਹੀਂ ਮਨ ਕਰਦਾ ਇਸ ਕਰਕੇ ਆਪਾਂ ਨੂੰ ਆਪਣੇ ਜਿਹੜੇ ਵਹੀਕਲਸ ਆ ਉਹ ਲਿਮਿਟ 'ਚ ਯੂਜ ਕਰਨੇ ਚਾਹੀਦੇ ਅਗਰ ਕਿਤੇ ਲਾਗੇ ਜਾਣਾ ਤਾਂ ਸਾਈਕਲ ਪਰੈਫਰ ਕਰਨਾ ਚਾਹੀਦਾ ਵਾ ਵਗੈਰਾ ਵਗੈਰਾ ਇਹੀ ਚੀਜ਼ਾਂ ਕਰਕੇ ਪੇੜ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਆ ਇਹਦੇ ਕਰਕੇ ਆਪਾਂ ਐਟਮੋਸਫੇਅਰ ਦੇ ਵਿੱਚ ਚੇਂਜਸ ਲਿਆ ਸਕਦੇ ਆ ਗਲੋਬਲ ਵਾਰਮਿੰਗ ਨੂੰ ਘਟਾ ਸਕਦੇ ਆ ਸੋ ਆਪਾਂ ਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਥੈਂਕ ਯੂ ਸੋ ਮਚ